ਜੀ ਬਿਲਕੁਲ ਮੈਂ ਆਪਣੇ ਰਾਜ ਤੋਂ ਬਾਹਰ ਯਾਤਰਾ ਕੀਤੀ ਹੈ ਮੈਂ ਜਦੋਂ ਛੋਟੀ ਸੀ ਤਾਂ ਮੈਂ ਆਪਣੇ ਪਰਿਵਾਰ ਨਾਲ ਗਈ ਸ਼ਿਮਲਾ ਦੀ ਯਾਤਰਾ ਕੀਤੀ ਹੈ ਮੈਂ ਪੰਜਾਬ 'ਚ ਰਹਿੰਦੀ ਹਾਂ ਅਤੇ ਮੈਂ ਸ਼ਿਮਲਾ 'ਚ ਗਈ ਸੀ ਘੁੰਮਣ ਫਿਰਨ ਜੂਨ ਜੁਲਾਈ ਦੀ ਛੁੱਟੀਆਂ ਸੀ ਉਦੋਂ ਅਤੇ ਮੈਂ ਉਦੋਂ ਸਕੂਲ 'ਚ ਪੜ੍ਹਦੀ ਸੀ ਅਤੇ ਉਦੇਸ਼ਯ ਇਹ ਸੀ ਕਿ ਅਸੀਂ ਸ਼ਿਮਲਾ ਦੇਖਣਾ ਚਾਹੁੰਦੇ ਸੀ ਅਸੀਂ ਕਿਸੀ ਪਹਾੜੀ ਇਲਾਕਾ ਨੂੰ ਜਾਣਾ ਚਾਹੁੰਦੇ ਸੀ ਅਤੇ ਇਹ ਮੇਰੀ ਪਹਿਲੀ ਯਾਤਰਾ ਸੀ ਕਿਸੀ ਪਹਾੜੀ ਇਲਾਕੇ ਨੂੰ ਦੇਖਣ ਦੀ ਅਤੇ ਉਦੇਸ਼ਯ ਇਹ ਹੀ ਸੀ ਕਿ ਪੰਜਾਬ ਤੋਂ ਬਾਹਰ ਵੀ ਜਾ ਕੇ ਅਸੀਂ ਦੇਖੀਏ ਕਿ ਹੋਰ ਕੀ ਕਲਚਰ ਹੈ ਲੋਕ ਕਿਸ ਤਰ੍ਹਾਂ ਦੇ ਰਹਿੰਦੇ ਨੇ ਪੰਜਾਬ ਤੋਂ ਬਾਹਰ ਕਿੱਦਾਂ ਦੀ ਦੁਨੀਆਂ ਹੈ ਕਿੱਦਾਂ ਦੇ ਲੱਗਦੇ ਨੇ ਅਤੇ ਕੀ ਖਾਣ ਪੀਣ ਉਹਨਾਂ ਦਾ ਅਤੇ ਪੰਜਾਬ ਤੋਂ ਬਾਹਰ ਜਾ ਕੇ ਸਾਨੂੰ ਕਿੱਦਾਂ ਦਾ ਲੱਗਦਾ ਹੈ ਅਤੇ ਮੈਨੂੰ ਪੰਜਾਬ ਤੋਂ ਬਾਹਰ ਜਾ ਕੇ ਬਹੁਤ ਵਧੀਆ ਵੀ ਲੱਗਿਆ ਇੱਕ ਨਵਾਂ ਐਕਸਪੀਰੀਐਂਸ ਹੋ ਗਿਆ ਅਤੇ ਜਦੋਂ ਅਸੀਂ ਸ਼ਿਮਲਾ ਪਹੁੰਚੇ ਤਾਂ ਸ਼ਿਮਲਾ ਬਹੁਤ ਹੀ ਸੋਹਣਾ ਜਿੱਦਾਂ ਪਹਾੜ ਹੁੰਦੇ ਨੇ ਸੋਹਣੇ ਸਾਫ਼ ਸੁਥਰੇ ਅਤੇ ਇੱਕ ਸਭ ਤੋਂ ਵਧੀਆ ਚੀਜ਼ ਮੈਨੂੰ ਉੱਥੇ ਇਹ ਵੀ ਲੱਗੀ ਕਿ ਉੱਥੇ ਲਿਫ਼ਾਫ਼ੇ ਨਹੀਂ ਯੂਜ ਕਰਦੇ ਉਹ ਉੱਥੇ ਉਹ ਖਾਕੀ ਦੇ ਜਿਹੜਾ ਹੁੰਦਾ ਉਹ ਦੇ ਦਿੰਦੇ ਆ ਲਿਫ਼ਾਫ਼ੇ ਦੀ ਜਗ੍ਹਾ 'ਤੇ ਉਹ ਦਿੰਦੇ ਆ ਜੋ ਕਿ ਪਹਾੜਾਂ 'ਚ ਯੂਜ ਕਰਨੇ ਵੀ ਨਹੀਂ ਚਾਹੀਦੇ ਮੇਰੇ ਹਿਸਾਬ ਨਾਲ ਸ਼ਹਿਰਾਂ 'ਚ ਵੀ ਨਹੀਂ ਯੂਜ ਕਰਨੇ ਚਾਹੀਦੇ ਅਤੇ ਮੈਨੂੰ ਇਹ ਮੈਂ ਉੱਥੋਂ ਸਿਰਫ਼ ਇੱਕ ਚੀਜ਼ ਇਹ ਹੀ ਸਿੱਖ ਕੇ ਆਈ ਸੀ ਉਦੋਂ ਹੀ ਮੈਨੂੰ ਹਜੇ ਵੀ ਯਾਦ ਹੈ ਕਿ ਉੱਥੇ ਉਹ ਪੋਲੀਥੀਨ ਯੂਜ ਨਹੀਂ ਕਰਦੇ ਔਰ ਇਹ ਬਹੁਤ ਵਧੀਆ ਚੀਜ਼ ਸੀ ਮੇਰੀ ਨਜ਼ਰਾਂ 'ਚ